ਹਾਂਜੀ ਯੋਗਾ ਸਿਰਫ ਕਸਰਤ ਦਾ ਇੱਕ ਰੂਪ ਹੈ ਅਤੇ ਅਸੀਂ ਯੋਗਾ ਕਰਨ ਨਾਲ ਤੰਦਰੁਸਤ ਅਤੇ ਤੰਦਰੁਸਤ ਰਹਿੰਦੇ ਹਨ ਅਤੇ ਸੰਤੁਸ਼ਟ ਵੀ ਰਹਿੰਦੇ ਹਾਂ ਅਤੇ ਸਾਡੇ ਸਰੀਰ 'ਤੇ ਯੋਗਾ ਦਾ ਬਹੁਤ ਹੀ ਮਹੱਤਵਪੂਰਨ ਹੈ ਅਸੀਂ ਬਿਆਨ ਕਰਦੇ ਰਹਿੰਦੇ ਹਨ ਅਤੇ ਬਹੁਤ ਵਧੀਆ ਰਹਿੰਦੇ ਹਨ ਬਿਮਾਰੀਆਂ ਤੋਂ ਵੀ ਦੂਰ ਹੋ ਜਾਂਦੇ ਹਨ ਯੋਗਾ ਕਰਦੇ ਰਹੋ ਜੇ ਔਰ ਸਾਡੇ ਸਰੀਰ ਦੇ ਬਹੁਤ ਸਾਰੇ ਰੋਗ ਦੂਰ ਹੋ ਜਾਂਦੇ ਹਨ ਅਤੇ ਸਾਡੇ ਟੈਂਸ਼ਨ ਫ੍ਰੀ ਵੀ ਬਹੁਤ ਸਾਰੇ ਯੋਗਾ ਹੋ ਜਾਂਦੇ ਹਨ